ਸਤਾਈ ਸਤੰਬਰ ਉੱਨੀ ਸੌ ਉਣਹੱਤਰ ਪੰਜ ਨਵੰਬਰ ਉੱਨੀ ਸੌ ਬਹੱਤਰ ਤੇਈ ਫਰਵਰੀ ਉੱਨੀ ਸੌ ਅਠਾਨਵੇਂ ਚੌਦਾਂ ਦਸੰਬਰ ਉੱਨੀ ਸੌ ਇਕਾਨਵੇਂ ਇਕ ਜੁਲਾਈ ਦੋ ਹਜ਼ਾਰ ਦਸ